ਕੁਝ ਸਾਲ ਪਹਿਲਾਂ ਜਦੋਂ ਮੈਂ ਐਜ ਆ ਟੀਚਰ ਸਕੂਲ 'ਚ ਕੰਮ ਕਰਦੀ ਸੀ ਤਾਂ ਛੋਟੇ ਛੋਟੇ ਬੱਚਿਆਂ ਦੀਆਂ ਅਸੀਂ ਫੋਟੋਗ੍ਰਾਫਸ ਨੂੰ ਕੋਲਾਜ ਬਣਾਉਣ ਵਾਸਤੇ ਮੈਂ ਫੋਟੋਗਰਾ ਫੋਟੋ ਜਿਹੜੀ ਯੂਜ ਕਰਦੀ ਸੀ ਅਤੇ ਉਹਦੇ ਨਾਲ ਕੀ ਹੁੰਦਾ ਸੀ ਕਿ ਇੱਕ ਕੋਈ ਫੋਟੋ ਵਿੱਚ ਸਾਰੇ ਦੇ ਸਾਰੇ ਬੱਚੇ ਆ ਜਾਂਦੇ ਸੀ ਅਤੇ ਇਹਦੇ ਨਾਲ ਫਿਰ ਅਸੀਂ ਆਪਣੀਆਂ ਫੋਟੋਆਂ ਫੇਸਬੁਕ 'ਤੇ ਜਾਂ ਹੋਰ ਜਿਹੜਾ ਆਪਣਾ ਇੰਸਟਰਾਗ੍ਰਾਮ ਦੇ ਉੱਤੇ ਪੋਸਟ ਕਰਦੇ ਸੀਗੇ ਸਾਰੇ ਪੈਰੇਂਟਸ ਵੀ ਖੁਸ਼ ਹੋ ਜਾਂਦੇ ਸੀਗੇ ਸਾਰੇ ਕਿਉਂਕਿ ਉਹਨਾਂ ਦੇ ਬੱਚਿਆਂ ਦੇ ਸਭ ਦੇ ਬੱਚਿਆਂ ਦੀ ਫੋਟੋਜ਼ ਆ ਜਾਂਦੀਆਂ ਸੀ ਉਹਦੇ ਵਿੱਚ